ਜੀ ਹਾਂ ਬੜੀਆਂ ਇਛਾਵਾਂ ਨੇ ਭਵਿੱਖ ਵਿੱਚ ਗਾਉਣ ਦੀਆ ਮੈਂ ਭਵਿੱਖ ਵਿੱਚ ਘਰ ਪਰਿਵਾਰ ਦੇ ਖੁਸ਼ੀਆਂ ਦੇ ਮੌਕਿਆਂ 'ਤੇ ਖੁੱਲ ਕੇ ਬੋਲੀਆਂ ਪਾਉਣਾ ਚਾਹੁੰਦੀ ਆ ਜਦੋਂ ਮੈਂ ਆਪਣੀਆਂ ਸਹੇਲੀਆਂ ਨਾਲ ਹੋਵਾਂ ਕਿਸੇ ਵੀ ਪਾਰਟੀ 'ਤੇ ਉਹਨਾਂ ਨਾਲ ਮਿਲ ਕੇ ਗਾਉਣ ਵਜਾਉਣ ਦਾ ਬੜਾ ਹੀ ਆਨੰਦ ਮਿਲਦਾ ਮੈਨੂੰ ਪੰਜਾਬੀ ਟੱਪੇ ਬੜੇ ਚੰਗੇ ਲੱਗਦੇ ਨੇ ਇਸ ਤੋਂ ਇਲਾਵਾ ਪੁਰਾਣੇ ਸੁਹਾਗ ਘੋੜੀਆਂ ਵੀ ਮਨ ਨੂੰ ਟੁੰਬਦੇ ਨੇ ਵਿਆਹਵਾਂ ਮੌਕੇ ਸਿੱਠਣੀਆਂ ਦੇਣਾ ਵੀ ਬੜਾ ਚੰਗਾ ਲੱਗਦਾ ਰੂਹਾਨੀ ਕੀਰਤਨ ਵੀ ਮਨ ਨੂੰ ਬਹੁਤ ਸਕੂਨ ਪ੍ਰਦਾਨ ਕਰਦਾ ਹੈ ਬੜਾ ਚਿੱਤ ਕਰਦਾ ਹੈ ਰੂਹ ਨਾਲ ਬਾਣੀ ਸਿਮਰਨ ਕਰਨ ਦਾ